ਤੁਸੀਂ ਓਲਾ ਕੈਬ ਤੋਂ ਬੋਲ ਰਹੇ ਹੋ ਹਾਂਜੀ ਹਾਂਜੀ ਵੀਰ ਜੀ ਤੁਸੀਂ ਨਾ ਆਪਾਂ ਡੇਰਾ ਬਾਬਾ ਨਾਨਕ ਜਾਣਾ ਹਾਂਜੀ ਗੁਰ ਡਿਸਟ੍ਰਿਕਟ ਗੁਰਦਾਸਪੁਰ ਸਾਈਡ 'ਤੇ ਅਤੇ ਤੁਸੀਂ ਆਪਣੀ ਮੈਂ ਤੁਹਾਡੀ ਕੈਬ ਬੁੱਕ ਕਰਵਾਉਣੀ ਸੀ ਅਸੀਂ ਨਾ ਤਿੰਨ ਤਿੰਨ ਸਵਾਰੀਆਂ ਹਾਂ ਅਤੇ ਤੁਸੀਂ ਆਪਣੀ ਕੈਬ ਦੇ ਚਾਰਜ਼ਸ ਦੱਸ ਦਿਉ ਅਤੇ ਕੈਬ ਸਾਡੀ ਜ਼ਿਆਦਾ ਹਾਂਜੀ ਹਾਂਜੀ ਵੱਡੀ ਜ਼ਿਆਦਾ ਕੈਬ ਸਾਨੂੰ ਨਹੀਂ ਚਾਹੀਦੀ ਸਾਨੂੰ ਤਿੰਨ ਸਵਾਰੀਆਂ ਦੀ ਚਾਹੀਦੀ ਆ ਅਤੇ ਤੁਸੀਂ ਸਾਨੂੰ ਇੱਥੋਂ ਸੈਲੀਬ੍ਰੇਸ਼ਨ ਕਲੋਨੀ ਜੋ ਤਰਨਤਾਰਨ ਰੋਡ 'ਤੇ ਆ ਤੁਸੀਂ ਸਾਨੂੰ ਉੱਥੋਂ ਪਿੱਕ ਕਰਨਾ ਹਾਂਜੀ ਅਤੇ ਤੁਸੀਂ ਅਤੇ ਡੇਰਾ ਬਾਬਾ ਨਾਨਕ ਜਾਣਾ ਅਤੇ ਓ ਪੰਜ ਮਾਰਚ ਹਨ ਹਾਂਜੀ ਪੰਜ ਮਾਰਚ ਨੂੰ ਅਤੇ ਅਰਲੀ ਮੋਰਨਿੰਗ ਹਾਂਜੀ ਅੱਠ ਕੁ ਵਜੇ ਤੱਕ ਤੁਸੀਂ ਸਾਨੂੰ ਪਿੱਕ ਕਰ ਸਕਦੇ ਹੋ ਅਤੇ ਤੁਸੀਂ ਸਾਨੂੰ ਆਪਣੀ ਗੱਡੀ ਦੇ ਚਾਰਜ਼ਸ ਦੱਸ ਦਿਉ ਅਤੇ ਵੱਡੀ ਕੈਬ ਨਹੀਂ ਏ ਸੀ ਗੱਡੀ ਚਾਹੀਦੀ ਹੈ ਸਾਨੂੰ ਅਤੇ ਉੱਪਰ ਸਮਾਨ ਰੱਖਣ ਵਾਸਤੇ ਵੀ ਜਗ੍ਹਾ ਹੋਏ ਗੱਡੀ ਵੱਡੀ ਹੋ ਨਹੀਂ ਚਾਹੀਦੀ ਗੱਡੀ ਠੀਕ ਹੀ ਹੋਏ ਏ ਸੀ ਗੱਡੀ ਚਾਹੀਦੀ ਆ ਆ ਅਰਲੀ ਮੋਰਨਿੰਗ ਹਾਂਜੀ ਅੱਠ ਕੁ ਵਜੇ ਤੱਕ ਤੁਸੀਂ ਸਾਨੂੰ ਤਰਨਤਾਰਨ ਰੋਡ 'ਤੇ ਸੈਲੀਬ੍ਰੇਸ਼ਨ ਕਲੋਨੀ ਤੋਂ ਅਤੇ ਉਹ ਐਡਰੈੱਸ ਤੁਹਾਨੂੰ ਮੈਂ ਦੱਸ ਦੂੰਗੀ ਹਾਊਸ ਨੰਬਰ ਹੈਗਾ ਵਾ ਸੱਤ ਸੌ ਪੈਂਹਠ ਹਾਂਜੀ ਤੁਸੀਂ ਸਾਨੂੰ ਇੱਥੋਂ ਪਿੱਕ ਕਰਨਾ ਹਾਂਜੀ ਡੇਰਾ ਬਾਬਾ ਨਾਨਕ ਜਾਣਾ ਅਸੀਂ ਅਤੇ ਤੁਸੀਂ ਮੈਨੂੰ ਅ ਗੱਡੀ ਦੇ ਚਾਰਜ਼ਸ ਦੱਸ ਦਿਉ ਅਤੇ ਜ ਛੋਟੀ ਅੱਛਾ ਜੀ ਛੋਟੀ ਗੱਡੀ ਦੇ ਦੋ ਹਜ਼ਾਰ ਅਤੇ ਵੱਡੀ ਗੱਡੀ ਦੇ ਤਿੰਨ ਹਜ਼ਾਰ ਆ ਠੀਕ ਆ ਨਹੀਂ ਆਪਾਂ ਫਿਰ ਛੋਟੀ ਗੱਡੀ ਬੁੱਕ ਕਰ ਲੈਂਦੇ ਹਾਂ ਅਤੇ ਤੁਸੀਂ ਸਾਨੂੰ ਪੰਜ ਮਾਰਚ ਨੂੰ ਸਵੇਰੇ ਅੱਠ ਵਜੇ ਤਰਨ ਤਾਰਨ ਰੋਡ 'ਤੇ ਸੈਲੀਬ੍ਰੇਸ਼ਨ ਕਲੋਨੀ ਹੈ ਇੱਥੋਂ ਤੁਸੀਂ ਸਾਨੂੰ ਪਿੱਕ ਕਰ ਲਿਓ ਠੀਕ ਹੈ ਹਾਂਜੀ ਜੀ ਧੰਨਵਾਦ